ਹੈਲੋ ਹਾਂਜੀ ਮੈਮ ਮੇਰੀ ਫਰੈਂਡ ਨੇ ਨਾ ਤੁਹਾਡਾ ਨੰਬਰ ਦਿੱਤਾ ਸੀਗਾ ਹਾਂਜੀ ਅਸੀਂ ਨਾ ਐਕਚੁਲੀ ਬੰਬਈ ਤੋਂ ਹੁਣੇ ਸ਼ਿਫਟ ਹੋਏ ਹਾਂ ਉਰੇ ਪਟਿਆਲੇ ਅਤੇ ਅਸੀਂ ਮਤਲਬ ਉਰੇ ਆਪਣਾ ਮਕਾਨ ਲਿਆ ਗਾ ਅਸੀਂ ਪੁੱਛਣਾ ਸੀਗਾ ਵੀ ਮੈਂ ਨਾ ਇੱਥੋਂ ਕੋਈ ਵਿਆਹ ਆ ਰਿਹਾ ਸਾਡੇ ਅਤੇ ਮੈਂ ਨਾ ਥੋੜਾ ਸਮਾਨ ਲੈਣਾ ਸੀਗਾ ਜਿੱਦਾਂ ਜੁੱਤੀ ਸੂਟ ਵਗੈਰਾ ਹੈ ਨਾ ਅਤੇ ਮੈਂ ਮੈਂ ਪੁੱਛਣਾ ਸੀਗਾ ਵੀ ਉਰੇ ਸਭ ਤੋਂ ਵਧੀਆ ਬਾਜ਼ਾਰ ਮਤਲਬ ਕਿ ਕਿੱਦਾਂ ਜਾਣਾ ਆਉਣਾ ਹੈ ਨਾ ਤੁਸੀਂ ਦੱਸ ਸਕਦੇ ਹੋ ਵੀ ਉਹ ਕਹਿ ਰਹੇ ਸੀ ਕਿ ਉਹ ਜ਼ਿਆਦਾ ਘੁੰਮਦੇ ਨਾ ਬਾਜ਼ਾਰ ਤੁਹਾਨੂੰ ਪਤਾ ਹੈਗਾ ਕਿਹੜਾ ਬਾਜ਼ਾਰ ਵਧੀਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਪ੍ਰਾਈਜ਼ ਵਗੈਰਾ ਮੈਮ ਇਹਨਾਂ ਦਾ ਕੀ ਹੁੰਦਾ ਵੈਸੇ ਅੱਛਾ ਜੀ ਵੈਸੇ ਮੈਮ ਉਰੇ ਓ ਜਿੱਥੇ ਮਤਲਬ ਜੇ ਅਦ ਅਦਾਲਤ ਜਾਣਾ ਹੋਵੇ ਤਾਂ ਕਿੱਦਾਂ ਜਾਣਾ ਪਏਗਾ ਕਿਉਂਕਿ ਇੱਧਰ ਪਤਾ ਨਹੀਂ ਨਾ ਪਟਿਆਲੇ ਦਾ ਐਨਾ ਬਸ ਸਟੈਂਡ ਵੀ ਚੇਂਜ ਹੋ ਗਿਆ ਤਾਂ ਕਰਕੇ ਹਾਂਜੀ ਅੱਛਾ ਜੀ ਠੀਕ ਹੈ ਜੀ ਅਤੇ ਆਟੋ ਦੀ ਉਹ ਕਿੰਨਾ ਆਉਂਦਾ ਕਿਰਾਇਆ ਵਗੈਰਾ ਓਕੇ ਓਕੇ ਠੀਕ ਹੈ ਮੈਮ ਥੈਂਕ ਯੂ ਜੀ ਧੰਨਵਾਦ ਤੁਹਾਡਾ ਦੱਸਣ ਲੀਏ ਅਤੇ ਕੀਮਤੀ ਸਮਾਂ ਦੇਣ ਲਈ ਥੈਂਕ ਯੂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਮ ਥੈਂਕ ਯੂ ਜੀ